ਹੈਲੋ ਹਾਂਜੀ ਚੇਤਨ ਬੁੱਕ ਡਿਪੋ ਤੁਹਾਡਾ ਸਵਾਗਤ ਕਰਦਾ ਹੈਗਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂ ਮੜੀਏ ਦੀਵਾ 'ਚ ਹੋਰ ਕਿਹੜਾ ਜੀ ਓਕੇ ਜੀ

ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਆਪਣੀ ਦੁਕਾਨ 'ਤੇ ਹਰ ਕਿਤਾਬ ਦੀ ਵਰਾਇਟੀ ਮੌਜੂਦ ਹੈਗੀ ਅਤੇ ਆਪਣੇ ਕੋਲ ਕਿਤਾਬਾਂ ਤੋਂ ਬਿਨਾ ਜਿਹੜੇ ਨਾਵਲ ਵਗੈਰਾ ਨੇ ਹੋਰ ਸਾਰਾ ਪੋਇਟਰੀ ਵਗੈਰਾ ਦਾ ਚਲ ਲੱਗਿਆ ਹੋਇਆ ਆਪਣਾ ਖੁੱਲ੍ਹਾ ਸਟਾਲ ਲੱਗਾ ਹੋਇਆ ਹੈਗਾ ਆਪਾਂ ਸਾਹਮਣੇ ਹੀ ਆਪਣੇ ਜਿਹੜਾ ਨਵਾਂ ਪਲੋਟ ਖਰੀਦ ਕੇ ਆਪਾਂ ਉੱਧਰਲੇ ਪਾਸੇ ਸ਼ਿਫਟ ਕੀਤੀ ਹੈ ਦੁਕਾਨ ਅਤੇ ਕੋਈ ਗੱਲ ਨਹੀਂ ਤੁਸੀਂ ਆਓ ਆ ਕੇ ਵਿਜ਼ਿਟ ਕਰੋ ਅਤੇ ਜਿਹੜਾ ਤੁਹਾਨੂੰ ਕੋਈ ਨਾਵਲ ਵਗੈਰਾ ਚਾਹੀਦਾ ਹੋਇਆ ਤਾਂ ਹਰ ਇੱਕ ਪ੍ਰਕਾਰ ਦੀ ਵਰਾਇਟੀ ਮਿਲੇਗੀ ਤੁਹਾਨੂੰ ਨਾਵਲ ਸਾਰੇ ਕੋਈ ਵੀ ਤੁਹਾਨੂੰ ਪੰਜਾਬੀ 'ਚ ਨਾਵਲ ਚਾਹੀਦਾ ਹੈਗਾ ਜਾਂ ਇੰਗਲਿਸ਼ 'ਚ ਚਾਹੀਦਾ ਹੈਗਾ ਹਿੰਦੀ ਚਾਹੀਦਾ ਸਾਡੇ ਕੋਲ ਵਰਾਟੀਆਂ ਸਾਡੇ ਕੋਲ ਮੌਜੂਦ ਹੁੰਦੀਆਂ ਰਹੀਆਂ ਸਾਰਿਆਂ ਦੇ ਸਾਰੇ ਤਕਰੀਬਨ ਸਾਰਿਆਂ ਦੇ ਮਿਲ ਜਾਣਗੇ ਜੀ ਕੋਈ ਗੱਲ ਨਹੀਂ ਜੇ ਤੁਹਾਨੂੰ ਕੋਈ ਹੋਰ ਵੀ ਕੋਈ ਸਪੈਸ਼ਲ ਚਾਹੀਦਾ ਹੋਇਆ ਸਾਡੀ ਆਪਣੀ ਦੁਕਾਨ 'ਤੇ ਨਾ ਹੋਇਆ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦੇਵਾਂਗੇ ਜੀ ਅਸੀਂ ਕਾਹਦੇ ਵਾਸਤੇ ਹਾਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਜੀ

ਵਾਧੂ ਜੀ ਵਾਧੂ ਵਾਧੂ ਵਾਧੂ ਵਾਧੂ ਵਾਧੂ ਵਾਧੂ ਵਾਧੂ ਕਿੰਨੇ ਮਰਜ਼ੀ ਤੁਸੀਂ ਬੱਚੇ ਨੂੰ ਲੈ ਆਇਓ ਕੋਈ ਗੱਲ ਨਹੀਂ ਜਿਹੜੀ ਉਹਨੂੰ ਕਹਾਣੀ ਟਾਈਪ ਪਸੰਦ ਹੋਇਆ ਉਹ ਲੈ ਜਾ ਸਕਦੇ ਜਾਂ ਅਸੀਂ ਆਪ ਲਿਜਾ ਸਕਦੇ ਹੋਂਗੇ ਅਤੇ ਕਿਹਨੂੰ ਮਰਜ਼ੀ ਲਿਜਾ ਸਕਦੇ ਹੋਂਗੇ ਕੋਈ ਗੱਲ ਨਹੀਂ ਬੱਚੇ ਨੂੰ ਵੀ ਨਾਲ ਲਿਆ ਸਕਦਾ ਹੋ ਸਾਡੇ ਕੋਲ ਬੱਚਿਆਂ ਦੀ ਕਹਾਣੀਆਂ ਦੀ ਵਾਧੂ ਹੁੰਦੀਆਂ ਨੇਗੀਆਂ ਜਿੰਨੇ ਵੀ ਇਹ ਆਪਣੇ ਆਪਣੇ ਕੋਲ ਤਾਂ ਕਹਾਣੀਆਂ ਦਾ ਬਹੁਤ ਕਿਤਾਬਾਂ ਦਾ ਭੰਡਾਰ ਪਿਆ ਜੀ ਤੁਸੀਂ ਦੇਖਦੇ ਹੰਭ ਜਾਉਂਗੇ ਬਹੁਤ ਕਿਤਾਬਾਂ ਪਈਆਂ ਨੇਗੀਆਂ ਅਲੱਗ ਅਲੱਗ ਤਰ੍ਹਾਂ ਰੱਖ ਲੈਂਦਾ ਇਸ ਵੇਲੇ ਸਾਡੇ ਕੋਲ ਜਿਹੜੀ ਸੈਲਫਾਂ ਨੇਗੀਆਂ ਅਲੱਗ ਅਲੱਗ ਤਰ੍ਹਾਂ ਰੱਖੀਆਂ ਹੋਈਆਂ ਨੇਗੀਆਂ ਜਿਹੜੀਆਂ ਆਪਣੀਆਂ ਬੱਚਿਆਂ ਵਾਸਤੇ ਅਲੱਗ ਨੇਗੀਆਂ ਅਤੇ ਬੜੀ ਉਮਰ ਦੇ ਜਿਹੜੇ ਆਪਣੇ ਆਪਣੀ ਹਮ ਉਮਰ ਵਾਸਤੇ ਪੜ੍ਹਦੇ ਹਾਂ ਕਿਤਾਬਾਂ ਉਹ ਅਲੱਗ ਰੱਖੀਆਂ ਹੋਈਆਂ ਨੇਗੀਆਂ ਅਤੇ ਇੱਕ ਅਲੱਗ ਉਹਨਾਂ ਦੇ ਕੋਰਨਰ ਬਣਾਏ ਹੋਏ ਨੇਗੇ ਤੁਸੀਂ ਜਿਸ ਤਰ੍ਹਾਂ ਦਾ ਸਾਨੂੰ ਕਹੇਗਾ ਇੱਕ ਮੁੰਡਾ ਤੁਹਾਡੇ ਨਾਲ ਭੇਜ ਦਿੱਤਾ ਜਾਵੇਗਾ ਕੋਈ ਪ੍ਰੋਵਾਈਡ ਕਰਾ ਦੂਗਾ ਉਸ ਹਿਸਾਬ ਨਾਲ ਤੁਸੀਂ ਆਪ ਵੀ ਉਹਦੇ ਵਿੱਚ ਸਰਚ ਮਾਰ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਜੀ ਆਪਣਾ ਸਾਰਾ ਆਪਣਾ ਵੱਡੇ ਪੱਧਰ 'ਤੇ ਲੈਵਲ 'ਤੇ ਕੰਮ ਆ ਜੀ ਆਪਣਾ ਕੋਈ ਛੋਟੀ ਮੋਟੀ ਦੁਕਾਨ ਨਹੀਂ ਹੈਗੀ ਆਪਣਾ ਬਹੁਤ ਵਧੀਆ ਕਰਨੇ ਵਾਲਾ ਕੰਮ ਆ ਜੀ

ਹਾਂਜੀ ਹਾਂਜੀ ਨਹੀਂ ਨਹੀਂ ਜੋ ਆਪਣੇ ਪੋਥੀਆਂ ਹਾਂ ਹਾਂ ਬਹੁਤ ਸ਼ਰਧਾ ਪੂਰਵਕ ਰੱਖੀਆਂ ਗੀਤ ਦਾ ਪਾਠ ਹੈਗੀਆਂ ਹੈਗੀਆਂ ਉਹ ਵੀ ਆਪਣੇ ਕੋਲ ਸਾਰਾ ਗੀਤਾ ਸਾਰੀਆਂ ਹੈਗੀਆਂ ਨੇਗੀਆਂ ਉਹ ਕਿਤਾਬਾਂ ਧਾਰਮਿਕ ਕਿਤਾਬਾਂ ਨੇਗੀਆਂ ਉਹਦਾ ਅਸੀਂ ਅਲੱਗ ਕੋਰਨਰ ਬਣਾਇਆ ਹੋਇਆ ਹੈਗਾ ਅਤੇ ਉਹ ਵਿੱਚ ਨਹੀਂ ਰੱਖੀਆਂ ਹੋਈਆਂ ਸਾਰੀਆਂ ਅਲੱਗ ਰੱਖੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਸਾਰੀਆਂ ਮਿਲ ਜਾਣਗੀਆਂ ਜੀ ਜੇ ਤਾਂ ਹੁਣ ਵਾਕਈ ਪੂਰੀ ਸਾਫ ਸੁਥਰੀਆਂ ਕਿਤਾਬਾਂ ਬਹੁਤ ਵਧੀਆ ਨਾਲ ਤੁਸੀਂ ਉਹ ਵੀ ਲਿਜਾ ਸਕਦੇ ਹੋ ਜੀ ਹਾਂ ਉਹ ਤਾਂ ਵਾਧੂ ਵਾਧੂ ਉਹ ਆਪਣੇ ਪਈਆਂ ਹੁੰਦੀਆਂ ਨੇ ਜੀ ਸ਼ਿਵਜੀ ਦੇ ਵਰਤ ਹੋ ਗਏ ਜਾਂ ਕੋਈ ਆਪਣਾ ਕੋਈ ਉਹੀ ਉਹ ਅਸ਼ਟਮੀ ਦੇ ਵਰਤ ਹੋ ਗਏ ਜਾਂ ਦਿਵਾਲੀ ਜ਼ੰਕਸ਼ਨ ਦੀ ਪੂਜਾ ਹੋ ਗਈ ਜਾਂ ਹਨੂੰਮਾਨ ਚਾਲੀਸਾ ਹੋ ਗਿਆ ਇਹ ਵੀ ਆਪਣੇ ਕੋਲ ਸਰ ਕੋਲ ਸਾਰੀ ਵਰਾਇਟੀ ਮਿਲ ਜਾਊਗੀ ਤੁਹਾਨੂੰ ਮੈਂ ਅਜੇ ਹੁਣ ਦੱਸ ਨਹੀਂ ਸਕਦਾ ਤੁਸੀਂ ਉਦੋਂ ਜਦ ਤੁਸੀਂ ਆਵੋਗੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਸਾਡੇ ਕੋਲ ਤਾਂ ਬਹੁਤ ਭੰਡਾਰ ਪਿਆ ਜੀ ਕੋਈ ਅਸੀਂ ਹਾਂਜੀ ਹਾਂਜੀ ਹਾਂਜੀ ਲੈਸ ਵਗੈਰਾ ਹੁੰਦਾ ਵਾ ਚਾਲੀ ਪਰਸੈਂਟ ਡਿਸਕਾਊਂਟ ਲਾਉਂਦੇ ਹਾਂ ਜੀ ਇਹਦੇ ਉੱਪਰ ਚਾਲੀ ਪਰਸੈਂਟ ਡਿਸਕਾਊਂਟ ਲੱਗ ਜਾਂਦਾ ਹੈਗਾ ਤੁਸੀਂ ਜੇ ਆਓਗੇ ਜਿੰਨਾ ਪ੍ਰਿੰਟ ਮੁੱਲ ਹੋਊਗਾ ਉਹ 'ਤੇ ਚਾਲੀ ਪਰਸੈਂਟ ਡਿਸਕਾਊਂਟ ਲਾ ਕੇ ਤੁਹਾਨੂੰ ਕਿਤਾਬਾਂ ਦਿੱਤੀਆਂ ਜਾਣਗੀਆਂ ਕੋਈ ਚਿੰਤਾ ਨਾ ਕਰੋ ਤੁਹਾਨੂੰ ਇਹ ਤੋਂ ਸਸਤੀਆਂ ਕਿਤਾਬਾਂ ਅਤੇ ਇੰਨੀ ਵਰਾਇਟੀ ਤੁਹਾਨੂੰ ਕਿਤੇ ਆਪਣੇ ਹੋਰ ਕਿਤੇ ਨਹੀਂ ਮਿਲ ਸਕਦੀ ਤੁਹਾਨੂੰ ਸਿਰਫ ਆਪਣੇ ਕੋਲ ਹੀ ਮਿਲ ਸਕਦੀ ਆ ਓਕੇ ਓਕੇ ਜੀ ਠੀਕ ਠੀਕ ਓਕੇ ਓਕੇ ਜ਼ਰੂਰ ਜੀ ਜ਼ਰੂਰ ਜੀ